ਜੇਕਰ ਕਿਸੇ ਵਿਅਕਤੀ ਨੂੰ ਸੱਪ ਨੇ ਡੰਗਿਆ ਹੈ ਤਾਂ ਵਿਅਕਤੀ ਨੂੰ ਕਿਤੇ ਆਰਾਮਦਾਇਕ ਥਾਂ ਲੇਟਣਾ ਚਾਹੀਦਾ ਹੈ ਜੇਕਰ ਵਿਅਕਤੀ ਨੇ ਘੜੀ ਮੁੰਦਰੀ ਕੜਾ ਚੂੜੀ ਆਦਿ ਕੋਈ ਤੰਗ ਚੀਜ਼ ਪਾਈ ਹੋਈ ਹੈ ਤਾਂ ਉਸਨੂੰ ਉਧਾਰ ਉਤਾਰ ਦੇਣਾ ਚਾਹੀਦਾ ਹੈ ਜਿੱਥੇ ਸੱਪ ਨੇ ਡੰਗਿਆ ਹੈ ਉਸ ਜਗ੍ਹਾ ਨੂੰ ਹਲਕੇ ਕੱਪੜੇ ਨਾਲ ਢੱਕ ਦੇਣਾ ਚਾਹੀਦਾ ਹੈ ਪੀੜਤ ਵਿਅਕਤੀ ਨੂੰ ਸ਼ਾਂਤ ਰੱਖਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ ਤਾਂ ਕਿ ਉਹ ਸਦਮੇ ਵਿੱਚ ਨਾ ਜਾਵੇ ਜਿੰਨੀ ਜਲਦੀ ਹੋ ਸਕੇ ਵਿਅਕਤੀ ਨੂੰ ਨੇੜੇ ਦੇ ਸਿਹਤ ਕੇਂਦਰ ਜਲਦੀ ਤੋਂ ਜਲਦੀ ਲੈ ਕੇ ਜਾਣਾ ਚਾਹੀਦਾ ਹੈ ਕੱਟੇ ਹੋਏ ਹਿੱਸੇ ਦੇ ਉੱਪਰ ਗਵਾਹ ਵਾਲੀ ਪੱਟੀ ਨੂੰ ਵੀ ਬੰਨਣਾ ਚਾਹੀਦਾ ਹੈ ਅਤੇ ਜ਼ਖ਼ਮ ਦੇ ਆਲੇ ਦੁਆਲੇ ਨਿਸ਼ਾਨ ਲਗਾਉਣਾ ਵੀ ਜ਼ਰੂਰੀ ਹੈ ਤਾਂ ਜੋ ਹਸਪਤਾਲ ਵਿੱਚ ਡਾਕਟਰ ਸੋਜ ਨੂੰ ਦੇਖ ਸਕੇ ਪ੍ਰਭਾਵਿਤ ਹਿੱਸੇ ਜਿਵੇਂ ਬਾਂਹ ਲੱਤ ਆਦਿ ਨੂੰ ਮਜਬੂਤੀ ਨਾਲ ਦਬਾਅ ਪਾ ਕੇ ਕੱਪੜੇ ਦੀ ਸਹਾਇਤਾ ਨਾਲ ਬੰਨਣਾ ਚਾਹੀਦਾ ਹੈ ਡਾਕਟਰੀ ਸਹਾਇਤਾ ਆਉਣ ਤੱਕ ਵਿਅਕਤੀ ਨੂੰ ਸ਼ਾਂਤ ਰੱਖਣਾ ਜ਼ਰੂਰੀ ਹੈ ਇਨ੍ਹਾਂ ਤਰੀਕਿਆਂ ਦੀ ਪਾਲਣਾ ਕਰਕੇ ਵਿਅਕਤੀ ਦੀ ਜਾਨ ਨੂੰ ਬਚਾਇਆ ਜਾ ਸਕਦਾ ਹੈ ਧੰਨਵਾਦ